ਹਾਂ ਅਸੀਂ ਸਵੇਰੇ ਸ਼ਾਮ ਨੂੰ ਦੌੜਦੇ ਹਾਂ ਅਤੇ ਦੌੜਨ ਵਿੱਚ ਮੈਂ ਸਮਾਂ ਘੰਟਾ ਬਤੀਤ ਕਰਦਾ ਹਾਂ ਅਤੇ ਦੌੜਨ ਦੇ ਨਾਲ ਸਾਡੇ ਜਿਹੜਾ ਸਰੀਰ ਹੈਗਾ ਸਾਡਾ ਹਾਰਟ ਮਜਬੂਤ ਹੁੰਦਾ ਹੈਗਾ ਅਤੇ ਮਨ ਨੂੰ ਤਾਜ਼ਗੀ ਮਿਲਦੀ ਹੈ ਅਤੇ ਜੋ ਜੋੜਾਂ ਦੇ ਦਰਦ ਨੂੰ ਮਜਬੂਤੀ ਮਿਲਦੀ ਹੈ ਅਤੇ ਹੱਡੀਆਂ ਮਜਬੂਤ ਹੁੰਦੀਆਂ ਹਨ ਅਤੇ ਜਿਹੜਾ ਅ ਮੇਰੇ ਸਰੀਰ ਦੀ ਜਿਹੜੀ ਫੈਟ ਹੈਗੀ ਉਹ ਲੋਸ ਹੁੰਦੀ ਆ ਅਤੇ ਅਤੇ ਜਿਹੜੀਆਂ ਸਰੀਰ ਵਿੱਚ ਖ਼ਤਰਨਾਕ ਬਿਮਾਰੀਆਂ ਉਹ ਵੀ ਦੂਰ ਹੁੰਦੀਆਂ

ਪੰਜਾਬੀ ਅਦਾਕਾਰ ਪੰਜਾਬੀ ਅਥਲੀਟ ਅ ਮਿਲਖਾ ਸਿੰਘ ਤੋਂ ਬਹੁਤ ਜ਼ਿਆਦਾ ਪ੍ਰੇਰਿਤ ਹਾਂ ਅਤੇ ਸਵੇਰੇ ਅਤੇ ਸ਼ਾਮ ਦੀ ਦੌੜ ਨਾਲ ਮੇਰੇ ਮੇਰੇ ਮੇਰੇ ਅੰਦਰ ਅ ਸੈਲਫ ਕੋਨਫੀਡੈਂਸ ਪੈਦਾ ਹੁੰਦਾ ਹੈ ਅਤੇ ਮੈਂ ਸਵੈ ਸ ਸਵੈ ਕੋਨਫੀਡੈਂਟ ਅ ਮਹਿਸੂਸ ਕਰਦਾ ਹਾਂ ਅਤੇ ਸਵੇਰੇ ਸ਼ਾਮ ਦੌੜਨ ਨਾਲ ਨਾਲ ਕੀ ਆ ਸਾਡੇ ਸਰੀਰ ਦੇ ਵਿੱਚ ਅ ਫੇਫੜਿਆਂ ਨੂੰ ਮਜਬੂਤੀ ਮਿਲਦੀ ਹੈ ਅਤੇ ਸਾਡੀ ਜਿਹੜੀ ਹੈ ਸਾਹ ਦੀ ਪ੍ਰਣਾਲੀ ਹੈ ਉਹਨੂੰ ਵੀ ਕੀ ਆ ਮਜਬੂਤ ਅ ਕਰਨ ਦੇ ਵਿੱਚ ਮਦਦ ਮਿਲਦੀ ਹੈ

ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਆਪਣੇ ਲੋਕਾਂ ਨੂੰ ਅਨਪੜ੍ਹ ਲੋਕਾਂ ਨੂੰ ਸਿਹਤ ਲਈ ਜਾਗਰੂਕ ਕਰਨਾ ਚਾਹੀਦਾ ਅਤੇ ਇਸ ਲਈ ਮੈਂ ਸਵੇਰੇ ਸ਼ਾਮ ਦੌੜਦਾ ਹਾਂ ਅਤੇ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਫਿੱਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਆਪਣੇ ਵੇਟ ਲ ਵੇਟ ਲੋਸ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹਾਂ